ਹੈਲੋ ਮੈਂ ਸਵਿ ਸਵਿਗੀ 'ਤੇ ਫੋਨ ਕਰ ਰਿਹਾ ਸਰ ਮੈਂ ਨਾ ਦਸ ਮਿੰਟ ਪਹਿਲਾਂ ਇੱਕ ਔਡਰ ਪਲੇਸ ਕੀਤਾ ਸੀ ਜਿਹਦੇ ਵਿੱਚ ਪੀਜ਼ਾ ਬਰਗਰ ਪੈਟੀ ਅਤੇ ਨਾਲ ਕੋਲਡ ਡਰਿੰਕ ਦਾ ਔਡਰ ਕੀਤਾ ਸੀ ਪਰ ਮੈਂ ਕੋਲਡ ਡਰਿੰਕ ਪਾਉਣਾ ਭੁੱਲ ਗਿਆ ਸੀ ਉਹ 'ਚ ਮੇਰਾ ਤੁਸੀਂ ਉਹਦੇ ਵਿੱਚ ਤਿੰਨ ਕੋਲਡ ਡਰਿੰਕਾਂ ਪਾ ਦੇਣਾ ਇੱਕ ਕੋਕਾ ਕੋਲਾ ਪੈਪਸੀ ਅਤੇ ਮੌਰਿੰਡਾ ਉਸ ਤੋਂ ਬਾਅਦ ਇਹ ਔਡਰ ਤੁਸੀਂ ਮੈਨੂੰ ਇਕੱਠੇ ਹੀ ਭੇਜਣਾ ਇਹ ਨਾ ਕਿ ਕਰਨਾ ਕਿ ਪਹਿਲੇ ਭੇਜ ਦੇਣਾ ਮੇਰਾ ਔਡਰ ਨੰਬਰ ਹੈਗਾ ਇਟਸ ਵਨ ਥਰਟੀ ਏਟ ਅਤੇ ਤੁਸੀਂ ਵਨ ਥਰਟੀ ਏਟ ਦੇ ਔਡਰ ਦੇ ਵਿੱਚ ਹੀ ਐਡ ਕਰਕੇ ਮੈਨੂੰ ਪਿਛਲੇ ਔਡਰ ਦੇ ਨਾਲ ਹੀ ਭੇਜ ਦੇਣਾ ਇਹ ਨਾ ਹੋਵੇ ਕਿ ਤੁਸੀਂ ਅੱਧਾ ਘੰਟਾ ਪਹਿਲਾਂ ਇਹ ਭੇਜ ਦਿਓ ਫਿਰ ਥ ਥੋੜ੍ਹੀ ਦੇਰ ਬਾਅਦ ਉਹ ਭੇਜੋ ਤਾਂ ਕਿ ਫਿਰ ਮੈਨੂੰ ਖਾਣ 'ਚ ਬਾਕੀ ਗੈਸਟ ਆਏ ਹੈ ਦਿੱਕਤ ਆ ਆਵੇਗੀ ਬਾਅਦ ਚੋਂ ਇਸ ਲਈ ਤੁਸੀਂ ਇਕੱਠਾ ਹੀ ਔਡਰ ਭੇਜ ਦੇਣਾ ਧੰਨਵਾਦ ਮੈਂ ਇਹ ਹੀ ਕਹਿਣਾ ਚਾਹਾਂਗਾ